ਪੇਂਡੂ ਖੇਤਰਾਂ ਵਿੱਚ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ ਕਿਉਂਕਿ ਜੇਕਰ ਜੇ ਜੇਕਰ ਬਾਰਿਸ਼ ਹੋਵੇ ਹੋਵੇ ਤਾਂ ਉਹ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਹ ਹੜ੍ਹਾਂ ਦਾ ਰੂਪ ਲੈ ਲੈਂਦੀ ਹੈ ਜਿਸ ਕਾਰਨ ਹੜ੍ਹ ਦੇ ਕਾਰਨ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ ਪਰ ਕਦੇ ਬਾਰਿਸ਼ ਕਦੇ ਹੁੰਦੀ ਹੀ ਨਹੀਂ ਇਸ ਕਾਰਨ ਕਿਸਾਨਾਂ ਨੂੰ ਸੋਕਾ ਪੈ ਜਾਂਦਾ ਹੈ ਸੋਕੇ ਦੇ ਕਿਸਾ ਸੋਕੇ ਦੇ ਕਾਰਨ ਉਹਨਾਂ ਦੀ ਜ਼ਮੀਨ ਬੰਜਰ ਹੋ ਜਾਂਦੀ ਹੈ ਜਿਸ ਕਰਕੇ ਉਹ ਉਸ ਉੱਪਰ ਕੋਈ ਵੀ ਫ਼ਸਲ ਨਹੀਂ ਬੀਜ ਸਕਦੇ ਫ਼ਸਲ ਨਹੀਂ ਬੀਜ ਸਕਦੇ ਫ਼ਸਲ ਦੇ ਨਾ ਹੋਣ ਕਰਕੇ ਉਹਨਾਂ ਦਾ ਬਹੁਤ ਹੀ ਨੁਕਸਾਨ ਹੁੰਦਾ ਹੈ ਕਿਉਂਕਿ ਹਰ ਕਿਸਾਨ ਆਪਣੀ ਫ਼ਸਲ ਉੱਤੇ ਹੀ ਨਿਰਭਰ ਕਰਦਾ ਹੈ ਅਤੇ ਉਹਨਾਂ ਦੇ ਕਮਾਈ ਦਾ ਸਾਧਨ ਘੱਟ ਜਾਂਦਾ ਹੈ ਕਿਸਾਨ ਦੀ ਸਭ ਤੋਂ ਮਹੱਤਵਪੂਰਨ ਉਹਨਾਂ ਦੀ ਖੇਤੀਬਾੜੀ ਹੁੰਦੀ ਹੈ ਉਹਨਾਂ ਨੂੰ ਕਈ ਵਾਰ ਕਿਸਾਨ ਦੀ ਮਦਦ ਸਰਕਾਰ ਵੀ ਨਹੀਂ ਕਰਦੀ ਕਿਉਂਕਿ ਕਿਸ ਕਿਉਂਕਿ ਸਰਕਾਰ ਸਮਝਦੀ ਹੈ ਕਿ ਕਿਸਾਨ ਆਪਣਾ ਗੁਜ਼ਾਰਾ ਆਪ ਕਰ ਸਕਦਾ ਹੈ